ਵਿਦਿਆਰਥੀ ਜੀਵਨ ਵਿੱਚ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਦਾ ਆਪਣਾ ਮਹੱਤਵਪੂਰਨ ਸਥਾਨ ਹੈ ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਜੀਵਨ ਦੇ ਵਿੱਚ ਆਮ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ ਅਨੁਸ਼ਾਸਨ ਸਦਾਚਾਰ ਜਿੱਤਣ ਦੀ ਤਾਂਘ ਆਪਣੀ ਪ੍ਰੇਮ ਪਿਆਰ ਸਬਰ ਨੂੰ ਕੁੱਟ ਕੁੱਟ ਕੇ ਭਰਦੀਆਂ ਹਨ ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਉੱਤੇ ਜਿੱਤ ਲੈਂਦੇ ਹਨ ਤਾਂ ਝੰਡੇ ਗੱਡਦੇ ਹਨ ਸਮੁੱਚੇ ਦੇਸ਼ ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ ਹੋਕੀ ਫੁੱਟਬੋਲ ਆਦਿ ਖੇਡਾਂ ਵਿੱਚ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ ਜਿਸ ਨਾਲ ਖਿਡਾਰੀ ਇੱਕ ਜੁੱਟ ਹੋ ਕੇ ਅਤੇ ਸਹਿਯੋਗ ਨਾਲ ਗੁਣ ਸਹਿਜੇ ਸਿੱਖ ਸਿੱਖ ਜਾਂਦੇ ਹਨ ਅਨੁਸ਼ਾਸਨ ਵਿੱਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਜਿਸ ਦਾ ਲਾਭ ਉਹਨਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਅਤੇ ਨਿਸ਼ਾ ਨਸ਼ੇ ਆਦਿ ਕੁਰੀਤੀਆਂ ਵਿੱਚ ਫਸ ਚੁੱਕੇ ਹਨ ਅਤੇ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੇ ਹਨ ਉਹਨਾਂ ਦੀ ਊਰਜਾ ਦੇ ਸਮੇਂ ਨੂੰ ਸਹੀ ਵਰਤੋਂ ਵਿੱਚ ਲਗਾਉਣ ਲਈ ਖੇਡਾਂ ਪ੍ਰਭਾਵਸ਼ਾਲੀ ਜ਼ਰੀਆ ਹੋ ਸਕ ਹੋ ਚੁੱਕਾ ਹੈ ਨੌਜਵਾਨਾਂ ਨੂੰ ਸੋਚ ਧਾਰਨੀ ਬਣਾਣ ਬਣਾਉਂਦੀਆਂ ਹਨ ਅਜ ਅਜੋਕੇ ਸਮੇਂ ਖਿਡਾਰੀਆਂ ਦੇ ਕਰੀਅਰ ਲਈ ਸ ਨਵੇਂ ਮੌਕੇ ਮਿਲ ਰਹੇ ਹਨ ਅੱਜ ਕੱਲ੍ਹ ਖਿਡਾਰੀਆਂ ਕੰਪਨੀਆਂ ਵੱਲੋਂ ਸੰਪ ਸਪੋਂਸਰ ਖੇਡ ਲੀਗ ਵਿੱਚ ਚੰਗੀ ਖਦ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ